ਸਰ ਸਤਿ ਸ਼੍ਰੀ ਅਕਾਲ ਸਰ ਮੈਂ ਏ ਬੀ ਪੀ ਨਿਊਜ ਤੋਂ ਬੋਲ ਰਿਹਾ ਸੀਗਾ ਅਰਸ਼ਦੀਪ ਸਿੰਘ ਸਰ ਤੁਹਾਡਾ ਨਾ ਇੰਟਰਵਿਊ ਲੈਣਾ ਸੀਗਾ ਕਿ ਅੱਜ ਕੱਲ੍ਹ ਜੋ ਵੀ ਤੁਹਾਡੇ ਸੋਸ਼ਲ ਪ੍ਰੋਜੈਕਟ ਚੱਲ ਰਹੇ ਨੇ ਉਹਨਾਂ ਦੇ ਬਾਰੇ

ਹਾਂਜੀ ਸਰ ਉਹਨਾਂ ਬਾਰੇ ਸਰ ਆਪਾਂ ਡਿਸਕਸ ਕਰਨਾ ਸੀਗਾ ਕਿ ਡਿਸਕਸ ਕਰਨਾ ਸੀਗਾ ਮਤਲਬ ਕਿ ਬ੍ਰੀਫ ਦੇ ਵਿੱਚ ਠੀਕ ਹੈ ਸਰ ਓਕੇ ਹਾਂ ਠੀਕ ਹੈ ਸਰ ਸਰ ਇਹ ਠੀਕ ਹੈ ਸਰ ਅਤੇ ਸਰ ਇਹ ਸਰਕਾਰ ਵੱਲੋਂ ਵੀ ਤੁਹਾਨੂੰ ਕੋਈ ਗਰਾਂਟ ਆਉਂਦੀ ਹੈ ਕਿ ਤੁਸੀਂ ਆਪ ਸੋਸ਼ਲ ਵਰਕ ਕਰ ਰਹੇ ਓਂ ਓਕੇ ਠੀਕ ਹੈ ਸਰ

ਠੀਕ ਹੈ ਸਰ ਤਾਂ ਸਰ ਜੇ ਜਿੱਥੋਂ ਆਪਾਂ ਨਾ ਸਕੂਲ ਲੈਦੇ ਆ ਉਹ ਸਕੂਲ ਵਧੀਆ ਹੋਣਗੇ ਠੀਕ ਹੈ ਸਰ ਠੀਕ ਹੈ ਸਰ ਅਤੇ ਸਰ ਫਿਰ ਉਹਨਾਂ ਦੇ ਫੂਡ ਵਗੈਰਾ ਦਾ ਇੰਤਜ਼ਾਮ ਸਾਰਾ ਕੁਛ ਅਤੇ ਜੋ ਵੀ ਉਹਨਾਂ ਦਾ ਖਾਣ ਪੀਣ ਦਾ ਹੁੰਦਾ ਓਕੇ ਸਰ ਠੀਕ ਹੈ ਸਰ ਹਾਂਜੀ ਠੀਕ ਹੈ ਸਰ ਅਤੇ ਸਰ ਜੇ ਉਹਨਾਂ ਦੀ ਸਿਹਤ ਨੂੰ ਸਹੀ ਰੱਖਣ ਲਈ ਆਪਾਂ ਨੂੰ ਕੀ ਕੀ ਕਰਦੇ ਹਾਂ ਤੁਸੀਂ ਇੱਥੇ ਮਤਲਬ ਕਿ ਖੇਡਾਂ ਵਗੈਰਾ ਅਲੱਗ ਅਲੱਗ ਚੀਜ਼ਾਂ ਜੋ ਹੁੰਦੀਆਂ ਐਕਟੀਵਿਟੀ ਠੀਕ ਹੈ ਸਰ ਓਕੇ ਠੀਕ ਹੈ ਸਰ ਠੀਕ ਹੈ ਸਰ ਹਾਂ ਸਰ ਧੰਨਵਾਦ ਤੁਹਾਡਾ ਬਹੁਤ ਬਹੁਤ ਅਤੇ ਬਸ ਇਹ ਹੀ ਗੱਲ ਕਰਨੀ ਤੁਹਾਡੇ ਨਾਲ ਅਤੇ ਹਾਂਜੀ ਸਰ ਠੀਕ ਹੈ ਜੀ ਸਰ ਓਕੇ